ਵੈਸੇ ਤਾਂ ਮੈਂ ਪੰਜਾਬ ਦੇ ਲਗਭਗ ਹਰੇਕ ਖੇਤਰ ਵਿੱਚ ਘੁੰਮਿਆ ਹਾਂ ਪਰ ਪੰਜਾਬ ਤੋਂ ਬਾਹਰ ਵੀ ਮੈਂ ਬਹੁਤ ਵਾਰ ਗਿਆ ਹਾਂ ਜਿਵੇਂ ਕਿ ਮੈਂ ਉੱਤਰਾਖੰਡ ਗਿਆ ਸੀ ਜਿੱਥੇ ਜਾਣ ਦਾ ਮੇਰਾ ਮਕਸਦ ਸੀ ਨੌਵੀਂ ਕਲਾਸ ਕਰਨ ਉੱਥੇ ਮੈਨੂੰ ਮੇਰੇ ਸਕੂਲ ਦੁਆਰਾ ਭੇਜਿਆ ਗਿਆ ਸੀ ਤਾਂ ਕਿ ਆਪਾਂ ਉੱਥੋਂ ਦੇ ਲੋਕਾਂ ਦੇ ਬਾਰੇ ਮੈਂ ਜਾਣ ਸਕਾਂ ਅਤੇ ਉੱਥੋਂ ਦੇ ਲੋਕਾਂ ਦੇ ਉੱਥੋਂ ਦੇ ਖੇਤਰ ਬਾਰੇ ਮੈਨੂੰ ਪੂਰੀ ਜਾਣਕਾਰੀ ਹੋਵੇ ਉੱਥੋਂ ਦੇ ਲੋਕਾਂ ਦੇ ਰਹਿਣ ਸਹਿਣ ਬਾਰੇ ਮੈਨੂੰ ਪਤਾ ਲੱਗੇ ਅਤੇ ਉਹ ਉੱਥੋਂ ਦੇ ਲੋਕਾਂ ਦੇ ਕੰਮ ਕਾਰ ਦਾ ਮੈਨੂੰ ਪਤਾ ਲੱਗੇ ਉੱਥੋਂ ਦੇ ਲੋਕਾਂ ਦੇ ਵਿਵਸਾਇਕ ਅਤੇ ਰਾਜਨੀਤਿਕ ਜੀਵਨ ਦਾ ਮੈਨੂੰ ਪਤਾ ਲੱਗੇ ਅਤੇ ਉਹ ਤੋਂ ਬਿਨਾਂ ਮੈਂ ਗੁਜਰਾਤ ਵੀ ਘੁੰਮ ਕੇ ਆਇਆ ਹਾਂ ਜਿੱਥੇ ਮੈਂ ਜਿੱਥੇ ਮੈਂ ਕ੍ਰਿਕਟ ਦਾ ਕੈਂਪ ਲਗਾਉਣ ਗਿਆ ਸੀ ਅਤੇ ਉੱਥੇ ਮੈਂ ਉੱਥੇ ਮੈਂ ਪੂਰਾ ਇੱਕ ਹਫ਼ਤਾ ਰਿਹਾ ਅਤੇ ਉੱਥੋਂ ਦੇ ਖਾਣਿਆਂ ਬਾਰੇ ਜਾਣਕਾਰੀ ਮਿਲੀ ਉੱਥੋਂ ਦੇ ਲੋਕਾਂ ਬਾਰੇ ਜਾਣਕਾਰੀ ਮਿਲੀ ਉੱਥੋਂ ਦੀ ਭਾਸ਼ਾ ਬਾਰੇ ਸਿੱਖਣ ਨੂੰ ਮਿਲਿਆ ਅਤੇ ਉੱਥੋਂ ਦੇ ਉੱਥੋਂ ਦੇ ਮੌਸਮ ਬਾਰੇ ਮੈਨੂੰ ਸਿੱਖਣ ਨੂੰ ਮਿਲਿਆ ਉਸ ਤੋਂ ਇਲਾਵਾ ਮੈਂ ਐਮ ਪੀ ਦੇ ਵਿੱਚ ਵੀ ਗਿਆ ਹਾਂ ਐਮ ਪੀ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਕਿ ਮੈਂ ਸਟੱਡੀ ਕਰਨ ਗਿਆ ਸੀ ਉੱਥੇ ਉੱਥੇ ਮੇਰੇ ਜਾਣ ਦਾ ਮੇਨ ਕਾਰਣ ਸੀਗਾ ਗ੍ਰੈਜੂਏਸ਼ਨ ਪੂਰੀ ਕਰਨੀ ਜਿੱਥੇ ਕਿ ਮੈਂ ਤਿੰਨ ਸਾਲ ਲਗਾਏ ਅਤੇ ਉੱਥੋਂ ਦੇ ਲੋਕਾਂ ਦੀ ਗਰੀਬੀ ਬਾਰੇ ਜਾਣ ਕੇ ਮੈਨੂੰ ਵਧੀਆ ਲੱਗਿਆ ਕਿਉਂਕਿ ਉੱਥੋਂ ਦੇ ਲੋਕ ਭਾਵੇਂ ਗਰੀਬ ਸਨ ਪਰ ਉਹਨਾਂ ਦੇ ਦਿਲ ਬਹੁਤ ਵਧੀਆ ਸਨ ਉੱਥੋਂ ਦੇ ਲੋਕ ਬਹੁਤ ਹੀ ਵਧੀਆ ਢੰਗ ਨਾਲ ਬਾਹਰੀ ਲੋਕਾਂ ਨੂੰ ਬਹੁਤ ਹੀ ਵਧੀਆ ਬੁਲਾਉਂਦੇ ਸਨ ਅਤੇ ਉਹਨਾਂ ਦਾ ਬਹੁਤ ਹੀ ਵਧੀਆ ਸੁਆਗਤ ਕਰਦੇ ਸਨ ਅਤੇ ਉੱਥੋਂ ਦੇ ਲੋਕ ਉੱਥੋਂ ਦੇ ਲੋਕ ਆਪਣੇ ਜੀਵਨ ਦਾ ਗੁਜ਼ਾਰਾ ਜ਼ਿਆਦਾਤਰ ਮੱਛੀਆਂ ਜਾਂ ਫਿਰ ਜਾਂ ਫਿਰ ਟਰੈਵਲਿੰਗ ਜਾਂ ਫਿਰ ਖਾਣਾ ਬਣਾ ਕੇ ਕਰਦੇ ਸਨ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਹਾੜੀ ਏਰੀਆ ਹੈ ਜਿਵੇਂ ਕਿ ਅਮਰ ਕੰਟਕ ਦੇ ਵਿੱਚ ਜਿੱਥੋਂ ਨਰਮਦਾ ਨਿਕਲਦੀ ਹੈ ਉੱਥੋਂ ਦੇ ਲੋਕ ਨਰਮਦਾ ਦੇ ਆਸੇ ਪਾਸੇ ਢਾਬੇ ਬਣਾ ਕੇ ਬੈਠੇ ਹਨ ਤਾਂ ਕਿ ਉੱਥੋਂ ਉੱਥੇ ਆਉਣ ਵਾਲੇ ਸਾਰਿਆਂ ਨੂੰ ਉਹ ਰੋਟੀ ਵਗੈਰਾ ਖਵਾ ਸਕਣ ਅਤੇ ਆਪਣੇ ਜੀਵਨ ਦਾ ਗੁਜਾਰਾ ਕਰ ਸਕ